ਸਤਾਰ੍ਹਾਂ ਅਗਸਤ ਉੱਨੀ ਸੌ ਨੱਬੇ ਪੰਜ ਨਵੰਬਰ ਦੋ ਹਜ਼ਾਰ ਸੱਤ ਸ਼ੱਬੀ ਜਨਵਰੀ ਉੱਨੀ ਸੌ ਪੰਜਾਹ ਵੀਹ ਮਾਰਚ ਦੋ ਹਜਾਰ ਸਤਾਰ੍ਹਾਂ ਦਸ ਫਰਵਰੀ ਦੋ ਹਜਾਰ ਤੇਈ